ਮੈਨੂੰ ਬਚਪਨ ਤੋਂ ਹੀ ਗਾਣੇ ਸੁਣਨ ਦਾ ਬਹੁਤ ਸ਼ੌਕ ਹੈ ਔਰ ਹਮੇਸ਼ਾ ਤੋਂ ਮੇਰੀ ਗਾਣੇ ਅਤੇ ਸੰਗੀਤ ਪ੍ਰਤੀ ਰੁਚੀ ਰਹੀ ਹੈ ਪਰ ਮੈਨੂੰ ਹਮੇਸ਼ਾ ਇਸ ਗੱਲ ਦਾ ਡਰ ਰਹਿੰਦਾ ਸੀ ਕਿ ਮੇਰੀ ਆਵਾਜ਼ ਚੰਗੀ ਨਹੀਂ ਹੈ ਅਤੇ ਇਸ ਕਰਕੇ ਮੈਂ ਕਦੇ ਵੀ ਗਾਉਣਾ ਪਸੰਦ ਨਹੀਂ ਸੀ ਕਰਦੀ ਜਦ ਮੈਂ ਆਪਣੇ ਕਮਰੇ ਵਿੱਚ ਇਕੱਲੀ ਹੁੰਦੀ ਸੀ ਤਾਂ ਫਿਰ ਮੈਂ ਕਈ ਵਾਰ ਗਾਣੇ ਗੁਣਗੁਣਾਉਂਦੀ ਸੀ ਅਤੇ ਮੈਨੂੰ ਇਸ ਵਿੱਚ ਚੰਗ ਚੰਗਾ ਵੀ ਲੱਗਦਾ ਸੀ ਪਰ ਜਦ ਕਦੀ ਵੀ ਮੈਂ ਕਿਸੇ ਦੇ ਸਾਹਮਣੇ ਗਾਵਾਂ ਤਾਂ ਛੋਟੇ ਹੁੰਦਿਆਂ ਉਹ ਮੇਰਾ ਬਹੁਤ ਮਜ਼ਾਕ ਉਡਾਉਂਦੇ ਸਨ ਜਿਸ ਕਰਕੇ ਮੇਰਾ ਜੋ ਆਤਮ ਵਿਸ਼ਵਾਸ ਆ ਉਹ ਘੱਟ ਗਿਆ ਫਿਰ ਮੈਨੂੰ ਇੱਦਾਂ ਲੱਗਣਾ ਸ਼ੁਰੂ ਹੋ ਗਿਆ ਕਿ ਮੈਨੂੰ ਕੁਝ ਨਹੀਂ ਆਉਂਦਾ ਅਤੇ ਗਾਣੇ ਦੇ ਪ੍ਰਤੀ ਮੇਰੀ ਰੁਚੀ ਬੇਕਾਰ ਹੈ ਬਟ ਜਿੱਦਾਂ ਜਿੱਦਾਂ ਮੈਂ ਵੱਡੀ ਹੁੰਦੀ ਗਈ ਮੇਰੀ ਗਾਣੇ ਦੀ ਪ੍ਰਤੀ ਰੁਚੀ ਹੋਰ ਵੱਧਦੀ ਗਈ ਮੈਨੂੰ ਸੰਗੀਤ ਨਾਲ਼ ਪਿਆਰ ਜਿਹਾ ਹੋ ਗਿਆ ਅਤੇ ਸੰਗੀਤ ਪ੍ਰਤੀ ਮੇਰਾ ਮਾਣ ਸਨਮਾਨ ਹੋਰ ਵੱਧ ਗਿਆ ਜਦ ਵੀ ਮੈਂ ਟੀ ਵੀ ਵਿੱਚ ਕੋਈ ਸ਼ੋਅ ਦੇਖਦੀ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਅਤੇ ਗਾਉਣ ਦਾ ਮਨ ਹੁੰਦਾ ਇਸ ਕਰਕੇ ਜਦੋਂ ਮੈਂ ਥੋੜ੍ਹਾ ਬਹੁਤ ਲੋਕਾਂ ਵਿੱਚ ਗੁਣਗੁਣਾਉਣਾ ਸ਼ੁਰੂ ਕੀਤਾ ਤਾਂ ਮੈਨੂੰ ਇੰਝ ਪ੍ਰਤੀਤ ਹੋਇਆ ਕਿ ਮੈਂ ਥੋੜ੍ਹਾ ਬਹੁਤ ਤਾਂ ਗਾ ਹੀ ਸਕਦੀ ਹਾਂ ਇਸ ਕਰਕੇ ਜਦ ਮੇਰੇ ਦੋਸਤ ਨੇ ਮੈਨੂੰ ਇੱਕ ਵਾਰੀ ਬਹੁਤ ਪ੍ਰਭਾਵਿਤ ਕੀਤਾ ਕਿ ਮੈਂ ਵਧੀਆ ਗਾਉਂਦੀ ਹਾਂ ਉਸ ਦਿਨ ਤੋਂ ਮੈਂ ਗਾਉਣਾ ਸ਼ੁਰੂ ਕੀਤਾ ਉਸ ਨੂੰ ਹੀ ਮੈਂ ਹਮੇਸ਼ਾ ਉਸਨੂੰ ਹੀ ਆਪਣੇ ਸੰਗੀਤ ਵਾਲੇ ਵੀਡੀਓਜ਼ ਭੇਜਦੀ ਸੀ ਉਹ ਉਸਦੀ ਤਾਰੀਫ਼ ਕਰਦਾ ਸੀ ਅਤੇ ਉਹ ਖੁਦ ਵੀ ਗਾਉਂਦਾ ਹੈ ਇਸ ਲਈ ਉਹ ਮੈਨੂੰ ਹਰ ਵਾਰੀ ਇਸ ਵਿਸ਼ੇ ਵਿੱਚ ਸਮਝਾਉਂਦਾ ਸੀ ਕਿ ਕੀ ਮੇਰੀ ਗਲਤੀਆਂ ਹਨ ਅਤੇ ਕੀ ਨਹੀਂ ਇਸ ਕਰਕੇ ਮੈਨੂੰ ਇਸ ਦਾ ਮੇਰੇ 'ਤੇ ਬਹੁਤ ਚੰਗਾ ਪ੍ਰਭਾਵ ਪਿਆ ਮੈਂ ਅਤੇ ਉਹ ਇਕੱਠੇ ਗਾਉਣਾ ਸ਼ੁਰੂ ਹੋ ਗਏ ਉਸ ਦੀ ਆਵਾਜ਼ ਵੀ ਬਹੁਤ ਚੰਗੀ ਹੈ ਅਤੇ ਉਸ ਦੀ ਆਵਾਜ਼ ਨਾਲ਼ ਹੀ ਪ੍ਰੋਤਸਾਹਿਤ ਹੋ ਕੇ ਮੈਂ ਹੋਰ ਗਾਉਣਾ ਸ਼ੁਰੂ ਕੀਤਾ ਅੱਜ ਕੱਲ੍ਹ ਵੀ ਅਸੀਂ ਕਦੀ ਕਦੀ ਇੱਕ ਦੂਜੇ ਨੂੰ ਗਾਣੇ ਗਾ ਕੇ ਭੇਜਦੇ ਹਾਂ ਅਤੇ ਇਸ ਨਾਲ਼ ਹੀ ਮੇਰੀ ਰੁਚੀ ਵੱਧਦੀ ਜਾਂਦੀ ਹੈ ਇਸ ਕਰਕੇ ਹੀ ਹੁਣ ਮੇਰਾ ਸੰਗੀਤ ਪ੍ਰਤੀ ਕਾਫ਼ੀ ਪ੍ਰਭਾਵ ਵਿਵਹਾਰ ਬਦਲ ਚੁੱਕਾ ਹੈ ਹੁਣ ਮੈਂ ਅਤੇ ਮੇਰਾ ਦੋਸਤ ਇਕੱਠੇ ਸੰਗੀਤ ਦੇ ਵਿਸ਼ੇ ਵਿੱਚ ਚਰਚਾ ਕਰਦੇ ਹਾਂ ਬਹੁਤ ਸਾਰੇ ਇੱਦਾਂ ਦੇ ਗਾਇਕ ਹਨ ਜਿਹਨਾਂ ਦਾ ਸਾਨੂੰ ਪਤਾ ਹੈ ਅਤੇ ਅਸੀਂ ਉਹਨਾਂ ਨੂੰ ਫੋ ਅਸੀਂ ਉਹਨਾਂ ਨੂੰ ਫੋਲੋ ਕਰਦੇ ਹਾਂ ਜੇਕਰ ਅਸੀਂ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਿਚਾਰ ਪੇਸ਼ ਕਰੀਏ ਹਰ ਕਿਸੇ ਦੇ ਸਾਹਮਣੇ ਆਪਣੀ ਰੁਚੀ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰੇ ਤਾਂ ਇਸ ਨਾਲ਼ ਸਾਡਾ ਧਿਆਨ ਉਹਨਾਂ ਚੀਜ਼ਾਂ ਵੱਲ ਖਿੱਚਿਆ ਜਾਂਦਾ ਹੈ ਅਜਿਹੀ ਚੀਜ਼ਾਂ ਨਾਲ਼ ਸਾਡਾ ਆਤਮ ਵਿਸ਼ਵਾਸ ਵੀ ਵੱਧਦਾ ਹੈ ਅਤੇ ਕੀ ਪਤਾ ਜੇ ਅਸੀਂ ਸੱਚੀ ਹੀ ਬਹੁਤ ਜ਼ਿਆਦਾ ਚੰਗਾ ਗਾਉਂਦੇ ਹਾਂ ਤਾਂ ਸਾਡਾ ਇਸ ਵਿੱਚ ਕੈਰੀਅਰ ਵੀ ਬਣ ਸਕਦਾ ਹੈ ਇਹੀ ਉਹ ਵਾਰਦਾਤ ਹੈ ਮੇਰੇ ਦੋਸਤ ਦੀ ਕਾਬਲੀਅਤ ਅਤੇ ਉਸਦੇ ਪ੍ਰਤੀ ਮੇਰਾ ਪਿਆਰ ਹੋਰ ਵੱਧਦਾ ਜਾਂਦਾ ਹੈ ਜਦੋਂ ਉਹ ਮੈਨੂੰ ਇਸ ਗੱਲ ਬਾਰੇ ਪ੍ਰੋਤਸਾਹਿਤ ਕਰਦਾ ਹੈ ਉਸਦੀ ਉਸਦੀ ਮਦਦ ਨਾਲ਼ ਹੀ ਅੱਜ ਮੇਰਾ ਸਿੰਗਿੰਗ ਵਿੱਚ ਇੰਨਾ ਜ਼ਿਆਦਾ ਧਿਆਨ ਅਤੇ ਰੁਚੀ ਹੈ ਹਾਲਾਂਕਿ ਅੱਜ ਦੇ ਜ਼ਮਾਨੇ ਵਿੱਚ ਪੜ੍ਹਾਈ ਵੀ ਬਹੁਤ ਜ਼ਰੂਰੀ ਹੈ ਬਟ ਪਰ ਅਸੀਂ ਕੀ ਕਰਦੇ ਹਾਂ ਕਿ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਜਦਕਿ ਇਹਨਾਂ ਵਿੱਚ ਬਹੁਤ ਜ਼ਿਆਦਾ ਰੁਚੀ ਹੈ ਜੇਕਰ ਅਸੀਂ ਸੱਚੇ ਦਿਲ ਨਾਲ਼ ਅਤੇ ਪੂਰੀ ਮਿਹਨਤ ਨਾਲ਼ ਆਪਣੇ ਪਸੰਦੀਦਾ ਵਿਸ਼ੇ ਬਾਰੇ ਸੋਚੀਏ ਉਹਦੇ 'ਤੇ ਮਿਹਨਤ ਕਰੀਏ ਤਾਂ ਉਸ ਵਿੱਚ ਵੀ ਵਧੇਰੇ ਅੰਕ ਪ੍ਰਾਪਤ ਕੀਤੇ ਜਾ ਸਕਦੇ ਹਨ ਉਸ ਵਿੱਚ ਵੀ ਸਾਡਾ ਕੈਰੀਅਰ ਬਣ ਸਕਦਾ ਹੈ ਅਤੇ ਸਾਡੇ ਲਈ ਉਹ ਬਹੁਤ ਜ਼ਿਆਦਾ ਸਹਾਇਕ ਹੋ ਸਕਦਾ ਇਹੀ ਸਾਰੀ ਸੋਚ ਦੇ ਨਾਲ਼ ਮੇਰੀ ਇਸ ਪ੍ਰਤੀ ਰੁਚੀ ਹੋਰ ਜ਼ਿਆਦਾ ਵੱਧਦੀ ਜਾਂਦੀ ਹੈ ਇਸ ਤੋਂ ਇਲਾਵਾ ਮੈਨੂੰ ਗਾਣੇ ਦੀ ਇਹ ਗੱਲ ਵੀ ਬਹੁਤ ਪਸੰਦ ਹੈ ਕਿ ਗਾਣਾ ਗਾਉਣ ਨਾਲ਼ ਵੀ ਅਤੇ ਸੁਣਨ ਨਾਲ਼ ਵੀ ਇੱਕ ਇਨਸਾਨ ਨੂੰ ਬਹੁਤ ਚੰਗਾ ਜਿਹਾ ਆਭਾਸ ਹੁੰਦਾ ਹੈ ਜਦ ਵੀ ਅਸੀਂ ਕਿਸੇ ਟੈਂਸ਼ਨ ਵਿੱਚ ਹੁੰਦੇ ਹਾਂ ਜਾਂ ਆਪਣੇ ਵਿਹਲੇ ਸਮੇਂ ਵਿੱਚ ਵੀ ਅਸੀਂ ਮਿਊਜੀ ਅਸੀਂ ਸੰਗੀਤ ਨਾਲ਼ ਆਪਣਾ ਮਨੋਰੰਜਨ ਕਰ ਸਕਦੇ ਹਾਂ ਸੰਗੀਤ ਸੰਗੀਤ ਮਨੋਰੰਜਨ ਦਾ ਇਕ ਵੱਡਾ ਮਾਧਿਅਮ ਬਣ ਚੁੱਕਾ ਹੈ ਇਸ ਕਰਕੇ ਅੱਜ ਕੱਲ੍ਹ ਟੀ ਵੀ ਵਿੱਚ ਵੀ ਇਸ ਦਾ ਬਹੁਤ ਪ੍ਰਚਾਰ ਹੈ ਬਹੁਤ ਸਾਰੇ ਗਾਇਕ ਗਾਇਕਾਂ ਅਜਿਹੀ ਚੀਜ਼ਾਂ ਨਾਲ਼ ਟੈਲੇਂਟ ਸ਼ੋਅ ਕਰਦੇ ਹਨ ਅਤੇ ਉਸ ਵਿੱਚੋਂ ਕਾਫ਼ੀ ਸਾਰਾ ਪੈਸਾ ਵੀ ਕਮਾ ਰਹੇ ਹਨ ਇਸ ਕਰਕੇ ਅੱਜ ਕੱਲ੍ਹ ਇਹਨਾਂ ਚੀਜ਼ਾਂ ਦਾ ਮਹੱਤਵ ਵੱਧ ਚੁੱਕਾ ਹੈ ਇਸ ਨਾਲ਼ ਹੀ ਮੈਂ ਇਹੀ ਉਹ ਦਿਨ ਸੀ ਜਦੋਂ ਮੇਰੇ ਦੋਸਤ ਨੇ ਮੈਨੂੰ ਇਸ ਵੇਲ ਇਸ ਬਾਰੇ ਸਮਝਾਇਆ ਅਤੇ ਇਸ ਨਾਲ਼ ਹੀ ਮੇਰਾ ਇਸ ਵਿੱਚ ਰੁਚੀ ਪੈਦਾ ਹੋਈ ਹੁਣ ਇਹ ਮੈਨੂੰ ਹਮੇਸ਼ਾ ਇਸ ਵੱਲ ਧਿਆਨ ਖਿੱਚਿਆ ਜਾਂਦਾ ਹੈ ਕਿਉਂਕਿ ਮੇਰੇ ਕੋਲ ਇੱਕ ਸਹਾਰਾ ਹੈ ਜਦੋਂ ਤੁਹਾਡਾ ਕੋਈ ਵਿਸ਼ਵਾਸ ਵਧਾ ਦਿੰਦਾ ਹੈ ਤਾਂ ਤੁਹਾਨੂੰ ਉਹਦੇ 'ਤੇ ਇੱਕ ਮਾਣ ਜਿਹਾ ਹੋ ਜਾਂਦਾ ਇਸ ਕਰਕੇ ਮੈਨੂੰ ਵੀ ਆਪਣੇ ਦੋਸਤ 'ਤੇ ਬਹੁਤ ਮਾਣ ਹੈ ਉਸ ਦੀ ਆਵਾਜ਼ ਵੀ ਬਹੁਤ ਪਿਆਰੀ ਹੈ ਅਤੇ ਜਦੋਂ ਉਹ ਗਾਉਂਦਾ ਹੈ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਹੈ ਉਹਨੂੰ ਗਾਉਂਦਿਆਂ ਦੇਖ ਕੇ ਮੇਰੀ ਵੀ ਹਿੰਮਤ ਵੱਧਦੀ ਜਾਂਦੀ ਹੈ ਇਸ ਲਈ ਕਈ ਵਾਰ ਮੈਂ ਉਸਦੇ ਨਾਲ਼ ਜਾਂ ਕਈ ਵਾਰੀ ਮੈਂ ਉਸ ਤੋਂ ਸਿੱਖ ਕੇ ਵੀ ਗਾਉਂਦੀ ਹਾਂ ਇਸ ਕਰਕੇ ਉਹਦੇ ਦਿੱਤੀਆਂ ਨਸੀਹਤਾਂ ਨਾਲ਼ ਹੀ ਮੇਰਾ ਪਹਿਲੀ ਵਾਰ ਗਾਉਣ ਵਿੱਚ ਰੁਚੀ ਹੋਈ ਅਤੇ ਹੁਣ ਇਸ ਦੇ ਨਾਲ਼ ਨਾਲ਼ ਹੀ ਮੇਰੀ ਰੁਚੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ ਮੈਨੂੰ ਨਹੀਂ ਪਤਾ ਕਿ ਮੇਰੀ ਆਵਾਜ਼ ਇੰਨੀ ਚੰਗੀ ਹੈ ਕਿ ਨਹੀਂ ਹੈ ਪਰ ਮਿਹਨਤ ਕਰਨਾ ਸਾਡਾ ਕੰਮ ਹੈ ਔਰ ਇੱਕ ਹੋਬੀ ਦੇ ਤੌਰ 'ਤੇ ਮਿਊਜ਼ਿਕ ਨੂੰ ਓਪਟ ਕਰਨਾ ਕੋਈ ਗਲਤ ਗੱਲ ਨਹੀਂ ਹੈ ਇਸ ਕਰਕੇ ਮੈਂ ਮਿਊਜਿਕ ਨੂੰ ਚੰਗਾ ਮੰਨਦੀ ਹਾਂ ਅਤੇ ਇੱਕ ਉੱਚੇ ਤਖ਼ਤ 'ਤੇ ਦੇਖਦੀ ਹਾਂ ਇਸ ਕਰਕੇ ਹੀ ਮੇਰੀ ਸੰਗੀਤ ਵਿੱਚ ਰੁਚੀ ਵੱਧਦੀ ਜਾ ਰਹੀ ਹੈ ਅਤੇ ਇਹੀ ਹੈ ਮੇਰੀ ਪਹਿਲੀ ਵਾਰ ਗਾਉਣ ਦੀ ਰੁਚੀ ਦਾ ਦਿਨ ਅਤੇ ਹੁਣ ਇਸ ਵੱਲ ਮੇਰਾ ਖਿੱਚਿਆ ਜਾਂਦਾ ਧਿਆਨ